ਅੱਜ ਦੇ ਸਮੇਂ ਵਿੱਚ ਬੈਂਕ ਤੋਂ ਕੀਤੀ ਜਾਣ ਵਾਲੀ ਟ੍ਰਾਂਜੈਕਸ਼ਨ ਜਿਵੇਂ ਕਿ ਪੈਸਾ ਕਢਵਾਉਣਾ ਅਤੇ ਪੈਸਾ ਜਮ੍ਹਾਂ ਕਰਨਾ ਇੰਟਰਨੈੱਟ ਦੀ ਮਦਦ ਨਾਲ਼ ਹੀ ਹੋ ਜਾਂਦਾ ਹੈ ਪਰ ਪਿਛਲੇ ਸਮੇਂ ਕੁਛ ਸਮੇਂ ਪਹਿਲਾਂ ਪਿਛਲੇ ਸਮੇਂ ਵਿੱਚ ਵੀ ਲੋਕਾਂ ਨੂੰ ਬੈਂਕ ਵਿੱਚ ਜਾਣਾ ਪੈਂਦਾ ਸੀ ਲੋਕਾਂ ਨੂੰ ਬੈਂਕ ਵਿੱਚ ਜਾ ਕੇ ਪੈਸਾ ਜਮ੍ਹਾਂ ਕਰਵਾਉਣਾ ਅਤੇ ਕਢਵਾਉਣਾ ਪੈਂਦਾ ਸੀ ਬੈਂਕਿੰਗ ਨੇ ਇਸ ਆਪਸ਼ਨ ਨੂੰ ਬਹੁਤ ਹੀ ਅੱਛਾ ਅਤੇ ਅਨੁਭਵੀ ਰੂਪ ਦੇ ਦਿੱਤਾ ਹੈ ਪਰ ਕੁਝ ਲੋਕ ਇਸ ਦੀ ਵਰਤੋਂ ਕਰਨ ਤੋਂ ਡਰਦੇ ਹਨ ਕਿਉਂਕਿ ਇਸ ਦੀ ਵਰਤੋਂ ਕਰਨ ਨਾਲ਼ ਫਰੋਡ ਦਾ ਵੀ ਡਰ ਹੋ ਜਾਂਦਾ ਹੈ ਅਤੇ ਈ ਬੈਂਕਿੰਗ ਦੇ ਨੂੰ ਕਰਨ ਲਈ ਕਾਫ਼ੀ ਸਾਰੇ ਪਲੈਟਫੋਰਮ ਹਨ ਜਿਵੇਂ ਕਿ ਗੂਗਲ ਪੇ ਰੂਪੇ ਬਾਰਤ ਪੇ ਅਤੇ ਇਹਨਾਂ ਦੀ ਵਰਤੋਂ ਨਾਲ਼ ਅਸੀਂ ਔਨਲਾਈਨ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ ਮੈਂ ਖੁਦ ਵੀ ਔਨਲਾਈਨ ਟ੍ਰਾਂਜੈਕਸ਼ਨ ਕਰਦੀ ਹਾਂ ਪਰ ਬਹੁਤ ਹੀ ਸੌਖੇ ਢੰਗ ਨਾਲ਼ ਕਰਦੀ ਹਾਂ